ਹੈਲੋ ਹਾਂਜੀ ਮੈਡਮ ਮੈਂ ਨਾ ਆਪਣੇ ਲੁਧਿਆਣੇ ਡਿਸਟ੍ਰਿਕਟ ਤੋਂ ਕੋਲ ਕਰ ਰਿਹਾ ਹਾਂ ਅਤੇ ਮੈਨੂੰ ਨਾ ਕਾਫੀ ਜ਼ਿਆਦਾ ਮੇਰੇ ਅ ਰਿਲੇਟਿਵਸ 'ਤੇ ਬਾਕੀ ਜਿਹੜੇ ਆ ਆਸ ਪਾਸ ਦੇ ਬੱਚੇ ਹੈਗੇ ਆ ਜਾਂ ਮਤਲਬ ਬਾਕੀ ਪੇਰੈਂਟਸ ਹੈਗੇ ਨਾ ਅਤੇ ਮੋਸਟਲੀ ਉਹਨਾਂ ਦੇ ਬੱਚੇ ਵੀ ਬਾਹਰ ਹੀ ਜਾ ਰਹੇ ਆ ਅਤੇ ਮੈਨੂੰ ਮੇਰਾ ਮੋਟਿਵ ਆਏ ਕੀ ਜੇ ਕੋਈ ਜਿੰਨਾ ਪੈਸਾ ਬਹਾਰ ਲਗਾਉਣਾ ਹੈਗਾ ਓਨਾ ਪੈਸੇ ਲਗਾ ਕੇ ਇੰਡੀਆ 'ਚ ਕੋਈ ਕੰਮ ਸ਼ੁਰੂ ਕਰ ਲਈਏ ਅਤੇ ਉਹ ਬੈਟਰ ਹੈ ਬਟ ਸਾਰੇ ਜਿੱਦਾਂ ਹੁਣ ਸਾਡੇ ਬੱਚੇ ਬਾਹਰ ਜਾ ਰਹੇ ਆ ਅਤੇ ਹੁਣ ਮੇਰਾ ਬੱਚਾ ਵੀ ਕਹਿ ਰਿਹਾ ਕਿ ਮੈਨੂੰ ਵੀ ਬਾਹਰ ਭੇਜੋ ਕਿ ਮੈਂ ਬਾਹਰ ਜਾਣਾ ਚਾਹੁੰਦਾ ਕਿਉਂਕਿ ਮੇਰੇ ਸਾਰੇ ਫਰੈਂਡਸ ਬਾਹਰ ਹੈਗੇ ਹੈ ਹੁਣ ਇਸ ਚੱਕਰ ਦੇ ਵਿੱਚ ਜੇ ਮੈਂ ਹੁਣ ਵੀਹ ਪੱਚੀ ਲੱਖ ਰੁਪਇਆ ਲਗਾ ਕੇ ਮੈਂ ਬੱਚੇ ਨੂੰ ਬਾਹਰ ਭੇਜਦਾ ਅਤੇ ਮੈਨੂੰ ਕੋਈ ਬੈਨੀਫਿਟ ਹੈਗਾ ਕਿ ਮੈਂ ਮਤਲਬ ਐਵੇਂ ਹੀ ਬਿਨਾਂ ਗੱਲ ਤੋਂ ਐਵੇਂ ਹੀ ਟੈਂਸ਼ਨ ਲੈ ਰਿਹਾ ਕਿ ਨਹੀਂ ਮੈਡਮ ਜਿੱਦਾਂ ਹੁਣ ਵੈਸੇ ਇਹਦਾ ਟਰੈਂਡ ਹੈਗਾ ਹੈ ਮੋਸਟਲੀ ਹੁੰਦਾ ਕਿਉਂ ਪਿਆ ਕਿਉਂਕਿ ਪਹਿਲਾਂ ਤਾਂ ਜਦੋਂ ਆਪਾਂ ਵੀ ਕੰਮ ਕਰਦੇ ਸੀਗੇ ਅਤੇ ਅਸੀਂ ਤਾਂ ਕਦੀ ਸੋਚਿਆ ਵੀ ਨਹੀਂ ਗਾ ਕੀ ਬਾਹਰ ਜਾਣਾ ਹੈਗਾ ਅਤੇ ਹੁਣ ਇਹ ਸਡਨਲੀ ਇੰਨਾ ਕਾਹਨੂੰ ਹੋ ਰਿਹਾ ਕਿ ਵੀ ਸਾਰੇ ਬੱਚੇ ਬਾਹਰ ਜਾਣ ਨੂੰ ਹੀ ਕਹਿੰਦੇ ਆ ਨਹੀਂ ਪਰ ਮੈਮ ਸਾਡੀ ਵਾਰ ਨੂੰ ਵੀ ਸਾਡੀ ਵਾਰ ਨੂੰ ਵੀ ਤਾਂ ਇੰਨੀ ਇਨਕਮ ਹੀ ਸੀਗੀ ਜਦੋਂ ਅਸੀਂ ਟੂ ਠਾਊਂਜੈਂਟ ਦੇ ਵਿੱਚ ਆਪਣੀ ਜੋਬ ਸਟਾਰਟ ਕੀਤੀ ਸੀ ਉਦੋਂ ਕਿੰਨੀ ਸੈਲਰੀ ਸੀਗੀ ਬਾਰਾਂ ਸੌ ਪੰਦਰਾਂ ਸੌ ਅਤੇ ਮੈਨੂੰ ਮੈਂ ਤਾਂ ਜਿੰਨਾ ਕੁ ਮੈਨੂੰ ਯਾਦ ਹੈ ਮੇਰੇ ਕੋਲ ਤਾਂ ਆਈ ਥਿੰਕ ਬਾਰਾਂ ਸੌ ਰੁਪਏ ਕਮਾਉਣ ਤੋਂ ਬਾਅਦ ਵੀ ਆਈ ਥਿੰਕ ਸੌ ਦੋ ਸੌ ਰੁਪਇਆ ਬ ਬਚਦਾ ਸੀਗਾ ਅਤੇ ਅੱਜ ਵੀ ਤਾਂ ਸੇਮ ਹੀ ਸਨਾਰੀਓ ਹੈਗਾ ਮੈਮ ਪਰ ਅਤੇ ਮੈਮ ਥੋੜ੍ਹਾ ਬਹੁਤ ਇਹਨਾਂ ਨੂੰ ਬੱਚਿਆਂ ਨੂੰ ਐਜੂਕੇਟ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੁਸੀਂ ਆਪਣੇ ਦਾ ਥੋੜ੍ਹਾ ਕਰੋ ਕਿ ਕਿਉਂਕਿ ਨਿਊਜ਼ ਮੀਡੀਆ ਦੇ ਉੱਤੇ ਵੀ ਆਹੀ ਮੋਸਟਲੀ ਦੇਖਿਆ ਜਾਂਦਾ ਕਿ ਵੀ ਇੱਥੇ ਮੈਡੀਕਲ ਸੈਂਟਰਸ ਪੰਜਾਬ 'ਚ ਘੱਟ ਹੈਗੇ ਅਤੇ ਆਈਲੈਟਸ ਸੈਂਟਰ ਜ਼ਿਆਦਾ ਹੈਗੇ ਹੈ ਅਤੇ

ਚਲੋ ਮੈਮ ਕੋਈ ਨਹੀਂ ਬਟ ਇਹ ਤੁਸੀਂ ਆਪਣੇ ਥੋੜ੍ਹਾ ਇਨਫਲੂਐਂਸ ਦੇ ਵਿੱਚ ਬਾਕੀ ਬੱਚਿਆਂ ਨੂੰ ਲੈ ਕੇ ਜਾਂ ਸਕੂਲ ਦੇ ਵਿੱਚ ਅ ਬੱਚਿਆਂ ਨੂੰ ਥੋੜ੍ਹਾ ਐਜੂਕੇਸ਼ਨ ਪ੍ਰੋਵਾਈਡ ਕਰਵਾਉਣੀ ਚਾਹੀਦੀ ਸਾਨੂੰ ਕਿਉਂਕਿ ਇੱਦਾਂ ਤਾਂ ਜੇ ਬੰਦੇ ਬਾਹਰ ਹੀ ਜਾਣ ਜਾਣ ਕਰਦੇ ਤਾਂ ਪੇਂਰਟਸ ਨੂੰ ਵੀ ਕਾਫੀ ਜ਼ਿਆਦਾ ਐਕਸਰ ਹੁੰਦਾ ਹੈਗਾ ਹਾਂਜੀ ਮੈਮ ਪਲੀਜ਼ ਮੈਮ ਇਹਦੇ ਬਾਰੇ ਕੋਈ ਦੇਖਿਓ